ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਓਕੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ

ਸਿੱਧੂ ਮੂਸੇਆਲੇ ਦੇ ਓਕੇ ਜੀ ਹਾਂਜੀ ਹਾਂਜੀ ਓਕੇ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਬਿਲਕੁਲ ਮੈਂ ਤੁਹਾਨੂੰ ਉਹਨਾਂ ਬਾਰੇ ਦੱਸ ਰਿਹਾ ਜੀ ਮੈਂ ਤੁਹਾਨੂੰ ਇੱਕ ਗੱਲ ਪੁੱਛ ਰਿਹਾ ਜੀ ਤੁਹਾਡੇ ਤੋਂ ਮੰਨ ਲਓ ਇੱਕ ਗੱਲ ਤੁਹਾਡੇ ਤੋਂ ਪੁੱਛ ਸਕਦਾ ਵਾ ਤੁਹਾਡੇ ਤੋਂ ਇੱਕ ਗੱਲ ਮੈਂ ਜੀ ਵੀ ਤੁਸੀਂ ਜੀ ਇਹਨਾਂ ਬਾਰੇ ਕਿਉਂ ਪੁੱਛ ਰਹੇ ਹੋ ਜੀ ਤੁਸੀਂ ਸਿੱਧੂ ਮੂਸੇਵਾਲੇ ਤੁਸੀਂ ਯਾਦ ਕਰ ਤੁਸੀਂ ਕੀ ਗੱਲ ਕਰਨੀ ਹੈ ਪੁੱਛ ਕੇ ਜੀ ਮੰਨ ਲਓ ਓਕੇ ਓਕੇ ਹੈ ਓਕੇ ਓਕੇ ਓਕੇ ਓਕੇ ਤੋਂ ਓਕੇ ਤੁਹਾਡੇ ਕਹਿਣ ਦਾ ਭਾਵ ਤੁਸੀਂ ਉਹਨਾਂ ਦੇ ਜੀਵਨ ਬਾਰੇ ਪੋਜੀਟੀਵਿਟੀ ਮੰਨ ਲਓ ਲਿਖੋਗੇ ਜੀ ਓਕੇ ਬਿਲਕੁਲ ਬਿਲਕੁਲ ਜੀ ਦੇਖਿਓ ਮੈਂ ਓਕੇ ਓਕੇ ਦੇਖਿਓ ਬਿਲਕੁਲ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਜਿਵੇਂ ਕਿ ਸਾਡੇ ਇਲਾਕੇ ਦੇ ਮੰਨ ਲਓ ਬਹੁਤ ਹੀ ਮ ਆਪਾਂ ਕਹਿ ਦੇਈਏ ਮਹਾਨ ਸ਼ਖਸੀਅਤ ਹੋਏ ਨੇ ਜੀ ਸਿੱਧੂ ਮੂਸੇਆਲਾ ਦੇਖੀ ਜੇ ਤੁਹਾਨੂੰ ਦੱਸਣਾ ਚਾਹੁੰਦਾ ਜੀ ਉਹਨਾਂ ਦਾ ਨਾਮ ਸ਼ੁਰੂ ਤੋਂ ਸਿੱਧੂ ਮੂਸੇਆਲਾ ਨਹੀਂ ਸੀਗਾ ਬਚਪਨ ਵਿੱਚ ਉਹਨਾਂ ਨਾਂ ਜੀ ਸੁਭਦੀਪ ਸਿੰਘ ਸੀ ਜੀ ਸੁਭਦੀਪ ਸਿੰਘ ਜਾਣੀ ਕਿ ਵਾ ਛੋਟੇ ਹੁੰਦੇ ਉਹਨਾਂ ਨਾਂ ਚ ਉਹਨਾਂ ਆਪਦੇ ਜੀ ਪਿੰਡ ਦੇ ਮੰਨ ਲਓ ਸਰਕਾਰੀ ਸਕੂਲ 'ਚ ਉਹਨਾਂ ਨੇ ਪਹਿਲਾਂ ਆਪਣੀ ਪੜ੍ਹਾਈ ਪੂਰੀ ਕੀਤੀ ਜੀ ਜਿਵੇਂ ਕਿ ਪਿੰਡ ਵਿੱਚ ਉਹਨਾਂ ਦਾ ਆਪਾਂ ਕਹਿ ਦਈਏ ਜਿਵੇਂ ਆਮ ਨੋਰਮਲ ਘਰ ਹੁੰਦੇ ਨੇ ਜੀ ਨੋਰਮਲ ਘਰਾਂ ਦੇ ਬੱਚੇ ਤੋਂ ਮੰਨ ਲਾ ਅ ਆਮ ਬੱਚਿਆਂ ਵਾਂਗ ਸੀ ਜੀ ਉਹ ਸਿਰ 'ਤੇ ਮੰਨ ਲਓ ਕੇਸ ਰੱਖੇ ਹੋਏ ਸੀ ਜੀ ਮੰਨ ਲਓ ਕਹਿਣ ਦਾ ਭਾਵ ਆਪਣਾ ਅਤੇ ਮਾਤਾ ਪਿਤਾ ਨੇ ਵਧੀਆ ਆ ਆਪਣੇ ਪਰਵਰਿਸ਼ ਕੀਤੀ ਸੀ ਸਾਰਾ ਕੁਛ ਕੀਤਾ ਸੀ ਜੀ ਅਤੇ ਵੱਡਿਆਂ ਹੁੰਦਿਆਂ ਗਏ ਹੌਲੀ ਹੌਲੀ ਮੰਨ ਲਓ ਉਹਨਾਂ ਨੂੰ ਥੋੜ੍ਹਾ ਮੋਟਾ ਮਿਊਜਿਕ ਵਿੱਚ ਉਹਨਾਂ ਨੂੰ ਸ਼ੌਕ ਸੀ ਜੇ ਸ਼ੁਰੂ ਤੋਂ ਮੰਨ ਲਓ ਗਾਉਣ ਦਾ ਕਹਿ ਦਈਏ ਸ਼ੁਰੂ ਤੋਂ ਸ਼ੌਕ ਸੀਗਾ ਜੀ ਫੇਰ ਉਹ ਹੌਲੀ ਹੌਲੀ ਉਹਨਾਂ ਨੇ ਮੰਨ ਲਓ ਆਪਣੇ ਪਿੰਡ ਲੈਵਲ 'ਤੇ ਆਪਣੀ ਸਟਡੀ ਪੂਰੀ ਕੀਤੀ ਜੀ ਫੇਰ ਉਹ ਮੰਨ ਲਓ ਕੈਨੇਡਾ ਵੀ ਗਏ ਆਪਣੀ ਸਟਡੀ ਵਾਸਤੇ ਅਤੇ ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਦੇਖੋ ਜੀ ਉਹਨਾਂ ਕੋਲ ਡਿਗਰੀ ਆਪਾਂ ਕਹਿ ਦਈਏ ਵੀ ਇੰਜੀਨੀਅਰਿੰਗ ਦੀ ਡਿਗਰੀ ਉਹਨਾਂ ਕੋਲ ਹੈਗੀ ਸੀ ਜੀ ਪਰ ਦੇਖੀਏ ਉਹਨਾਂ ਦਾ ਜਿਹੜਾ ਕਿ ਮੁਲਕ ਫੀਲਡ ਵਿੱਚ ਉੱਧਰ ਇਹਨਾਂ ਦਾ ਜ਼ਿਆਦਾ ਸ਼ੌਕ ਸੀ ਜੀ ਉਹਨਾਂ ਦਾ ਮੰਨ ਲਓ ਸ਼ੁਰੂ ਸ਼ੁਰੂ ਵਿੱਚ ਜਦੋਂ ਉਹਨਾਂ ਨੇ ਮੰਨ ਲਓ ਉਹਨਾਂ ਨੇ ਇੱਕ ਦੋ ਸੌਂਗ ਕੀਤੇ ਤਾਂ ਉੱਥੇ ਉਹਨਾਂ ਉਹਨਾਂ ਦਾ ਜਿਹੜਾ ਜਿਹੜਾ ਆਪਾਂ ਕਹਿ ਦਈਏ ਈਫੈਕਟ ਉਹਨਾਂ ਦਾ ਸਾਹਮਣੇ ਆਇਆ ਮੰਨ ਲਓ ਸਭ ਤੋਂ ਪਹਿਲਾਂ ਉਹਨਾਂ ਨੇ ਗਾਣੇ ਕੀਤੇ ਸੀ ਸਭ ਤੋਂ ਪਹਿਲਾਂ ਉਹਨੇ ਇੱਕ ਗਾਣਾ ਕੀਤਾ ਸੀ ਮੰਨ ਲਓ ਉਹ ਮੰਨ ਲਓ ਬਹੁਤ ਹਿਟ ਉਹਨਾਂ ਦਾ ਗਾਣਾ ਹੋਇਆ ਜੀ ਬਹੁਤ ਜ਼ਿਆਦਾ ਮੰਨ ਲਓ ਉਹਦੇ ਵਿਊ ਆਏ ਸਾਡੇ ਆਸ ਪਾਸ ਦੇ ਇਲਾਕੇ ਵਿੱਚ ਪਤਾ ਲੱਗਣ ਲੱਗਾ ਵੀ ਕੋਈ ਇੱਕ ਨਾਮ ਕੋਈ ਮੰਨ ਲਓ ਮੁੰਡਾ ਨਵਾਂ ਮੁੰਡਾ ਜੰਗ ਜਨਰੇਸ਼ਨ ਮੁੰਡਾ ਉੱਠਿਆ ਜੀ ਜੋ ਕਿ ਮੰਨ ਲਓ ਉਹ ਸਿੱਧੂ ਮੂਸੇਆਲੇ ਦੇ ਨਾਂ ਦੇ ਨਾਂ 'ਤੇ ਉਹਨਾਂ ਆਪਣਾ ਆਪਦਾ ਟੈਗ ਦਿੱਤਾ ਆਪਣੇ ਨਾਮ ਨੂੰ ਉਹਨਾਂ ਨੇ ਸ਼ੁਭਦੀਪ ਨਹੀਂ ਲਿਖਿਆ ਉਹਨਾਂ ਨੇ ਆਪਣੇ ਮੰਨ ਲਓ ਨਿਕ ਨੇਮ ਕਹਿ ਦਈਏ ਆਪਾਂ ਵੀ ਇੱਕ ਤਾਂ ਛੋਟਾ ਨਾਮ ਉਹਨਾਂ ਨੇ ਸਿੱਧੂ ਮੂਸੇਆਲੇ ਦੇ ਨਾਂ 'ਤੇ ਆਪਣਾ ਗਾਉਣਾ ਜਿਹੜਾ ਹੈਗਾ ਰਿਕੋਰਡ ਕੀਤਾ ਉਹਨਾਂ ਨੇ ਗਾਣਾ ਆਪਣਾ ਅਤੇ ਜਦੋਂ ਮੰਨ ਲਓ ਹੌਲੀ ਹੌਲੀ ਹਾਂਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਦੇਖੋ ਜੀ ਪਿੰਡ ਦੀ ਮਿੱਟੀ ਨਾਲ ਜੁੜਿਆ ਹੋਇਆ ਮੁੰਡਾ ਸੀ ਦੇਖੋ ਜੀ ਅਤੇ ਕਹਿਣ ਦਾ ਭਾਵ ਜੀ ਇੱਕ ਆਪਣੇ ਕਹਿਤਾ ਮੰਨ 'ਚ ਜਨੂੰਨ ਸੀ ਜੀ ਮੰਨ ਲਓ ਵੀ ਇਹ ਸਾਡੇ ਇੱਧਰਲੇ ਇਲਾਕੇ ਨੂੰ ਕਹਿੰਦੇ ਜੀ ਟਿੱਬਿਆਂ ਦਾ ਇਲਾਕਾ ਕਿਹਾ ਜਾਂਦਾ ਜੀ ਬਹੁਤ ਮਿੱਟੀ ਘੱਟਾ ਇੱਧਰ ਸਾਡੇ ਇਲਾਕੇ ਦੇ ਵਿੱਚ ਹੈਗਾ ਪਰ ਉਹ ਦਿਲ 'ਚ ਇੱਕ ਉਮੀਦ ਸੀ ਇੱਕ ਉਮ ਆਪਾਂ ਕਹਿ ਦਈਏ ਇੱਕ ਤਰ੍ਹਾਂ ਦਾ ਮਨ 'ਚ ਥੋਟ ਸੀ ਜੀ ਉਹਨਾਂ ਦੇ ਵੀ ਇਹ ਪਿੰਡ ਨੂੰ ਮੰਨ ਲਓ ਇੱਥੇ ਦੂਰ ਦੂਰ ਲੋਕ ਆਉਣ ਇੱਥੇ ਮੰਨ ਲਓ ਪਿੰਡ 'ਚ ਆ ਕੇ ਇਹ ਦੇਖਣ ਇਹਨੂੰ ਅਤੇ ਸਾਡੇ ਇਲਾਕੇ ਨੂੰ ਜਿਹੜਾ ਮੰਨ ਲਓ ਸਾਡਾ ਇਲਾਕਾ ਮਾਨਸਾ ਇਲਾਕਾ ਸਾਡਾ ਮੰਨ ਲਓ ਲੋਕ ਕਹਿੰਦੇ ਨੇ ਬੈਕਵਰਡ ਇਲਾਕਾ ਗਾ ਇਹਨੂੰ ਉਹਨਾਂ ਜੀ ਸੋਚ ਇੱਦਾਂ ਦੀ ਸੀ ਇਹਨੂੰ ਉੱਚਾ ਚੱਕਣਾ ਆਪਣੇ ਇਲਾਕੇ ਨੂੰ ਜੀ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਜੀ ਬਿਲਕੁਲ ਦੇਖੋ ਜੀ ਆਪਾਂ ਇੱਕ ਤਾਂ ਕਹਿ ਦਈਏ ਆਪਣੇ ਪੰਜਾਬ ਪੰਜਾਬ 'ਚ ਸੁਣਦੇ ਨੇ ਮੁੰਡੇ ਜੇ ਆਪਾਂ ਕਹਿ ਦਈਏ ਬਾਹਰਲੇ ਸਟੇਟਾਂ 'ਚ ਸੁਣਦੇ ਨੇ ਜੀ ਦੇਖੋ ਜੀ ਆਪਣੇ ਪੰਜਾਬ ਤੋਂ ਲੈ ਕੇ ਜੀ ਦੇਖੋ ਜੀ ਬਾਹਰ ਬਾਹਰ ਹੋਰਨਾਂ ਕੰਟਰੀਆਂ ਵਿੱਚ ਵੀ ਮੰਨ ਲਓ ਮੁੰਡਾ ਪ੍ਰਸਿੱਧ ਹੋਇਆ ਜੀ ਸਿੱਧੂ ਮੂਸੇਆਲਾ ਮੂਸੇਆਲੇ ਦੇ ਨਾਂ ਤੋਂ ਦੇਖੋ ਜੀ ਸੋਰਟਕੱਟ ਆਪਾਂ ਕਹਿ ਦਈਏ ਇੱਥੋਂ ਤੱਕ ਕੀ ਹੈ ਦੇਖੀਏ ਬਾਹਰਲੇ ਜੇ ਕਨੇਡਾ ਵਾਲੇ ਅਮਰੀਕਾ ਵਾਲੇ ਅਸਟੇਲੀਆ ਵਾਲੇ ਜਿਹੜੇ ਜੰਗ ਜਰਨੇਸ਼ਨ ਸੀ ਉਹ ਵੀ ਦੇਖੋ ਮੂਸੇਆਲਾ ਮੂਸੇਆਲਾ ਕਰਨ ਲਾਤੀ ਸੀ ਇੱਡੀ ਮੰਨ ਲਓ ਐਨੀ ਸਿਰਾ ਆਪਾਂ ਕਹਿ ਦਈਏ ਐਨੀ ਘੈਂਟ ਆਪਾਂ ਕਹਿ ਦਈਏ ਪੰਜਾਬੀ ਦੇ ਆਪਣੇ ਠੇਠ ਸ਼ਬਦਾਂ ਵਿੱਚ ਕਹਿ ਦਈਏ ਇੰਨੀ ਸੋਹਣੀ ਅਤੇ ਸੁਰੀਲੀ ਆਵਾਜ਼ ਅਤੇ ਉਹ ਲਿਖਤ ਇੰਨੀ ਘੈਂਟ ਸੀਗੀ ਲੋਕ ਕਹਿੰਦੇ ਸੀ ਵੀ ਬਸ ਉਹ ਇੱਕ ਤਰ੍ਹਾਂ ਦਾ ਮਿਲਣ ਦਾ ਜਨੂੰਨ ਸੀ ਵੀ ਹਾਂ ਇਹਨੂੰ ਬੰਦੇ ਨੂੰ ਜਾ ਕੇ ਮਿਲੀਏ ਜੀ ਐਨੀ ਹਾਂਜੀ ਬਿਲਕੁਲ ਬਿਲਕੁਲ ਐਨੀ ਘੈਂਟ ਸੀ ਦੇਖਿਓ ਜੀ ਬਾਕੀ ਬਹੁਤ ਉਹਨਾਂ ਨੇ ਗਾਣੇ ਤੁਸੀਂ ਸੁਣ ਕੇ ਦੇਖਿਓ ਜੀ ਬਾਕੀ ਪਿੰਡ ਆ ਕੇ ਦੇਖੋ ਜੀ ਹੁਣ ਤਾਂ ਦੇਖੋ ਬਹੁਤ ਸਾਰੀਆਂ ਇੱਦਾਂ ਦੀਆਂ ਆਪਾਂ ਕਹਿ ਦਈਏ ਹਾਲਾਤ ਹੋ ਗਏ ਮੰਨ ਲਓ ਕਈਆਂ ਨੂੰ ਉਹ ਮੰਨ ਲਓ ਸ਼ਖਸੀਅਤ ਮੰਨ ਲਓ ਚੰਗੀ ਨਹੀਂ ਲੱਗੀ ਜੀ ਅਤੇ ਐਂਡ ਵਿੱਚ ਦੇਖੀਏ ਵੀ ਹੁਣ ਕਈ ਕਾਰਨ ਕਰਕੇ ਉਹਨਾਂ ਦੀ ਜਿਹੜੀ ਹੈਗੀ ਆ ਡੈਥ ਹੋ ਗਈ ਆ ਉਹਨਾਂ ਦੀ ਮੰਨ ਲਓ ਉਹਨਾਂ ਦੇ ਦਿਨ ਦਿਹਾੜੇ ਗੋਲੀਆਂ ਨਾਲ ਉਹਨਾਂ ਦਾ ਕਤਲ ਕਰਤਾ ਗਿਆ ਅਤੇ ਬਾਕੀ ਉਹਨਾਂ ਦੇ ਤੁਸੀਂ ਪਿੰਡ ਆਇਓ ਤੁਹਾਨੂੰ ਬਹੁਤ ਹੋਰ ਵੀ ਤੁਹਾਨੂੰ ਬਰੀਕੀ ਨਾਲ ਤੁਹਾਨੂੰ ਜਾਣਕਾਰੀ ਮਿਲੇਗੀ ਡਿਟੇਲ ਵਿੱਚ ਤੁਸੀਂ ਲਿਖੋਗੇ ਬਾਕੀ ਤੁਸੀਂ ਦੇਖਿਓ ਜੀ ਰੋਡ ਉੱਪਰ ਉਹਨਾਂ ਦੀ ਹੈਗੀ ਜਿਹੜੀ ਹਵੇਲੀ ਹੈ ਬਿਲਕੁਲ ਬਿਲਕੁਲ ਦੇਖਿਓ ਬਾਹਰ ਨੇ ਐਨੀ ਐਨੀ ਵਧੀਆ ਸੋਚ ਸੀ ਜੀ ਬਾਹਰ ਨਹੀਂ ਰਹੇ ਪਿੰਡ ਵਿੱਚ ਉਹਨਾਂ ਨੇ ਆਪਦੀ ਹਵੇਲੀ ਪਾਈ ਹੈ ਪਿੰਡ ਵਿੱਚ ਹੀ ਰਹੇ ਹੈ ਹਾਂਜੀ ਬਿਲਕੁਲ ਬਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੁਸੀਂ ਪਿੰਡਾਂ ਆ ਕੇ ਜਾਇਓ ਤੁਸੀਂ ਵਿਜ਼ਿਟ ਕਰਿਓ ਜੀ ਓਕੇ ਓਕੇ ਥੈਂਕ ਯੂ ਓਕੇ ਜੀ